ਮੈਂ ਪਲਸ ਟੂ ਪਾਸ ਕਰਕੇ ਕੋਲੇਜ ਲੱਗਣ ਬਾਰੇ ਸੋਚ ਹੀ ਰਿਹਾ ਸੀ ਕਿ ਲੱਗ ਗਿਆ ਮੇਰੇ ਘਰਦੇ ਹਾਲਾਤ ਫਾਦਰ ਸ੍ਹਾਬ ਮੇਰੇ ਫਾਦਰ ਗੱਡੀ ਚਲਾਉਂਦੇ ਹੈ ਇੱਕ ਡਰਾਈਵਰ ਹੈ ਅਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੇ ਮੈਨੂੰ ਪੈਸੇ ਇਕੱਠੇ ਕਰਕੇ ਐਡਮੀਸ਼ਨ ਮੇਰੀ ਕੋਲੇਜ ਦੇ ਵਿੱਚ ਕਰਵਾਈ ਅਤੇ ਇੱਕ ਸਾਲ ਪੂਰਾ ਮੈਂ ਕਲੀਅਰ ਕੀਤਾ ਮੇਰੇ ਪੇਪਰ ਹੋ ਗਏ ਜਦੋਂ ਦੂਸਰੇ ਸਾਲ ਦੀ ਮੈਂ ਫੀਸ ਭਰਨ ਲੱਗਿਆ ਤਾਂ ਮੈਨੂੰ ਮੇਰੇ ਫਾਦਰ ਸ੍ਹਾਬ ਕਹਿੰਦੇ ਯਾਰ ਇੰਨੇ ਪੈਸੇ ਮੇਰੇ ਪਾਸ ਹੈ ਨਹੀਂ ਆ ਅਤੇ ਮੈਂ ਤੈਨੂੰ ਕਿੱਦਾਂ ਦੇ ਸਕਦਾਂ ਤੂੰ ਖੁਦ ਕੋਈ ਕੰਮ ਕਰਲਾ ਨਾਲ ਪਾਰਟ ਟਾਈਮ ਕੰਮ ਕਰਲਾ ਜਾਂ ਕੁਝ ਕਰਲਾ ਹੈ ਨਾ ਤੂੰ ਆਪਣਾ ਦੇਖ ਵੀ ਕਿੱਦਾਂ ਕਰ ਸਕਦਾ ਪਰ ਮੇਰੇ ਹਾਲਾਤ ਇੱਦਾਂ ਦੇ ਨਹੀਂ ਹੈ ਵੀ ਮੈਂ ਤੇਰੀ ਇਸ ਸਾਲ ਦੀ ਫੀਸ ਭਰ ਸਕਾਂ ਅਤੇ ਇੱਕ ਮੇਰਾ ਮਿੱਤਰ ਹੈ ਜਿਸ ਦਾ ਨਾਮ ਸੁਖਵਿੰਦਰ ਸਿੰਘ ਹੈ ਮੈਂ ਉਹਦੇ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਵੀ ਇੱਦਾਂ ਇੱਦਾਂ ਕਰਕੇ ਹੁਣ ਕਿਆ ਕਰਿਆ ਜਾਵੇ ਤਾਂ ਉਹ ਮੈਨੂੰ ਕਹਿੰਦਾ ਯਾਰ ਦੇਖ ਫੈਮਿਲੀ ਘਰ ਪਰਿਵਾਰ ਜੇ ਚਲਾਉਣਾ ਤੇਰੀਆਂ ਦੋ ਛੋਟੀਆਂ ਭੈਣਾਂ ਇੱਕ ਛੋਟਾ ਭਰਾ ਏ ਸਭ ਤੋਂ ਵੱਡਾ ਤੂੰ ਹੀ ਹੈ ਜੇ ਤੂੰ ਉਨ੍ਹਾਂ ਨੂੰ ਉਨ੍ਹਾਂ ਦਾ ਅੱਗੇ ਕੁਝ ਸੋਚਣਾ ਤਾਂ ਤੈਨੂੰ ਇਹ ਫੈਸਲਾ ਲੈਣਾ ਪੈਣਾ ਕਿ ਤੂੰ ਆਪਣਾ ਪੜ੍ਹਾਈ ਛੱਡ ਕੇ ਆਪਣਾ ਕੋਈ ਕੰਮ ਕਿੱਤਾ ਸਿੱਖ ਲੈ ਜਾਂ ਕੰਮ ਕਰਨ ਲੱਗ ਜਾ ਜਿਸ ਦੇ ਨਾਲ ਦੋ ਚਾਰ ਹਜ਼ਾਰ ਰੁਪਿਆ ਦਸ ਹਜ਼ਾਰ ਤੂੰ ਕਮਾ ਕੇ ਆਪਣੇ ਫਾਦਰ ਸ੍ਹਾਬ ਦੀ ਆਪਣੇ ਪਿਤਾ ਦੀ ਹੈਲਪ ਕਰੇ ਉਨ੍ਹਾਂ ਨੂੰ ਪੈਸੇ ਲਿਆ ਕੇ ਦਵੇ ਅਤੇ ਉਨ੍ਹਾਂ ਦੀ ਜ਼ਿੰਦਗੀ ਸੁਧਰ ਸਕਦੀ ਹੈ ਤਾਂ ਤੈਨੂੰ ਕੰਮ ਕਰਨਾ ਚਾਹੀਦਾ ਹੈ ਮੇਰੀ ਤਾਂ ਮੰਨਣਾ ਇਹੀ ਹੈ ਬਾਕੀ ਜਿੱਦਾਂ ਤੈਨੂੰ ਠੀਕ ਲੱਗੇ ਤੂੰ ਉਵੇਂ ਕਰ ਸਕਦਾ ਐਂ ਫਿਰ ਮੇਰੇ ਮੈਂ ਆਪਣੇ ਆਪ ਨਾਲ ਸਲਾਹ ਕਰਕੇ ਕੋਲੇਜ ਛੱਡ ਕੇ ਇੱਕ ਆਪਣਾ ਕੰਮ ਕਿੱਤਾ ਸ਼ੁਰੂ ਕੀਤਾ ਜਿੱਥੇ ਮੈਂ ਹੁਣ ਜੌਬ ਕਰ ਰਿਹਾਂ ਚੰਗੇ ਪੈਸੇ ਮਿਲ ਰਹੇ ਹੈ ਠੀਕ ਹੈ ਘਰ ਦਾ ਪਰਿਵਾਰ ਵੀ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਹੋ ਰਿਹਾ ਧੰਨਵਾਦ